ਨਵੀਂ ਆਹ ਟੈਕਨੋਲਜੀ ਆਹ ਸਾਡੇ ਜੀਵਨ ਵਿੱਚ ਬਹੁਤ ਅੱ ਵਧੀਆ ਭੂਮਿਕਾ ਨਿਭਾਉਂਦੀ ਹੈ ਬਹੁਤ ਅਹਿਮ ਭੂਮਿਕਾ ਇਸਦੀ ਕਿਉਂਕਿ ਜਿਸ ਤਰ੍ਹਾਂ ਹੁਣ ਦੇਖੋ ਤੁਸੀਂ ਫੇਸਬੁਕ 'ਤੇ ਇੰਸਟਾਗ੍ਰਾਮ 'ਤੇ ਹੁਣ ਜੋ ਮਰਜ਼ੀ ਜੋ ਕਿਸੀ ਚੀਜ਼ ਕੋਈ ਵੀ ਚੀਜ਼ ਤੁਸੀਂ ਸਿੱਖਣੀ ਝਟ ਯੂਟਿਊਬ ਖੋਲ੍ਹੋ ਅਤੇ ਝਟ ਸਿੱਖ ਲਓ ਜਿਸ ਤਰ੍ਹਾਂ ਹੁਣ ਕਿਸੇ ਨੇ ਕੋਈ ਰੈਸਪੀ ਬਣਾਉਣੀ ਅਤੇ ਉਹ ਯੂਟੀਊਬ 'ਤੇ ਦੇਖ ਲਓ ਮੈਨੂੰ ਸ਼ੌਕ ਹੈਗਾ ਸਟਿਚਿੰਗ ਦਾ ਅਤੇ ਸਿਲਾਈ ਦਾ ਕਢਾਈ ਦਾ ਜੋ ਮਰਜ਼ੀ ਜੋ ਮਰਜ਼ੀ ਤੁਸੀਂ ਯੂਟੀਊਬ ਤੋਂ ਨਿਕਾਲੋ ਅਤੇ ਉਹ ਝਟ ਪਟ ਸਾਰਾ ਕੁਛ ਸਮਝਾ ਦਿੰਦੇ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ ਬੰਦਾ ਝਟ ਪਟ ਹੀ ਆਪਣਾ ਫੋਨ ਖੋਲ੍ਹੋ ਯੂਟਿਊਬ ਖੋਲ੍ਹੋ ਉਹਦੇ ਵਿੱਚੋਂ ਸਾਰਾ ਕੁਛ ਕੱਢ ਕੇ ਸਿੱਖ ਲਓ ਹੁਣ ਦੇਖੋ ਲੋਕਾਂ ਜਿਹਨਾਂ ਨੂੰ ਨਹੀਂ ਕੋਈ ਇਨਕਮ ਦਾ ਸੋਰਸ ਹੈਗਾ ਨਹੀਂ ਕੋਈ ਇਨਕਮ ਹੈਗੀ ਨਹੀਂ ਉਹ ਕੰਮ ਕਰ ਸਕਦੇ ਕਈ ਹੈਗੇ ਆ ਜਿਹਨਾਂ ਨੂੰ ਚੱਲ ਨੱਚਣ ਗਾਉਣ ਦਾ ਵੀ ਸ਼ੌਕ ਹੈਗਾ ਉਹ ਦੇਖੋ ਤੁਸੀਂ ਇਹਦੇ 'ਤੇ ਯੂਟਿ ਰੀਲਾਂ ਬਣਾ ਬਣਾ ਕੇ ਛੋਟੇ ਛੋਟੇ ਸਕ੍ਰਿਪਟ ਬਣਾ ਬਣਾ ਕੇ ਛੋਟੇ ਛੋਟੇ ਕਰਕੇ ਆਪਣੀ ਕਲਾ ਪ੍ਰਦਰਸ਼ਨ ਕਰਦੇ ਉਹ ਯੂਟੀਊਬ 'ਤੇ ਪਾ ਦਿੰਦੇ ਉਹਨਾਂ ਦੀ ਚੱਲ ਜਾਂਦੀ ਉਹਨਾਂ ਨੂੰ ਇਨਕਮ ਦਾ ਸੋਰਸ ਬਣ ਜਾਂਦਾ ਉਹਨਾਂ ਨੂੰ ਉੱਥੇ ਆਪਣੇ ਘਰ ਦੇ ਗੁਜ਼ਾਰੇ ਲਾਇਕ ਪੈਸੇ ਆ ਜਾਂਦੇ ਹੁਣ ਬਹੁਤ ਵਧੀਆ ਚੀਜ਼ ਬੰਦਾ ਰੈਸਪੀ ਕੋਈ ਬਣਾਓ ਝਟ ਉਹਦੇ 'ਤੇ ਪਾ ਦਿਓ ਯੂਟੀਊਬ 'ਤੇ ਝਟ ਤੁਹਾਨੂੰ ਉਹਦੇ ਉਹਦੇ ਵੀ ਤੁਹਾਨੂੰ ਕਮੈਂਟ ਆਉਣੇ ਅਤੇ ਉਹਦੇ ਵੀ ਲਾਈਕ ਆਉਣੇ ਉਹਦੇ ਤੁਹਾਨੂੰ ਪੈਸੇ ਮਿਲਣੇ ਇਸ ਕਰਕੇ ਤਕਨਾਲੋਜੀ ਦੀ ਬਹੁਤ ਵਧੀਆ ਬਹੁਤ ਅੱਛੇ ਤਰੀਕੇ ਨਾਲ ਲੋਕਾਂ ਨੂੰ ਬਹੁਤ ਬੈਨੀਫਿਟ ਹੈ ਧੰਨਵਾਦ